ਹਾਂਜੀ ਸਿੱਖਿਆ ਦੇ ਰੂਪ ਵਿੱਚ ਬੱਚਿਆਂ ਨੂੰ ਜਿੱਦਾਂ ਸ਼ਹਿਰਾਂ ਵਿੱਚ ਆਪਾਂ ਵੱਡੇ ਕੋਲਜ ਸਕੂਲ ਬਣਾਏ ਹੋਏ ਆ ਅਤੇ ਪਿੰਡਾਂ ਵਿੱਚ ਸਾਨੂੰ ਇਹ ਚੁਣੌਤੀ ਵੇਖਣ ਨੂੰ ਮਿਲਦੀ ਆ ਕਿ ਨਾ ਤਾਂ ਵੱਡੇ ਸਕੂਲ ਆ ਅਗਾਂਹ ਪੜ੍ਹਨ ਵਾਸਤੇ ਅਤੇ ਨਾ ਤਾਂ ਕੋਈ ਕੋਲਜ ਵਾ ਜਿਹਨਾਂ ਨਾਲ ਬੱਚੇ ਅਗਾਂਹ ਦੀ ਪੜ੍ਹਾਈ ਕੰਪਲੀਟ ਕਰ ਸਕਣ ਪੂਰੀ ਕਰ ਸਕਣ ਆਪਣੀ ਜਿਵੇਂ ਕਿ ਬੱਚਿਆਂ ਨੇ ਡੋਕਟਰ ਦੀ ਲਾਈਨ 'ਚ ਪੈਣਾ ਹੁੰਦਾ ਵਾ ਕੋਰਸ ਕਰਨਾ ਹੁੰਦਾ ਵਾ ਜਾਂ ਇੰਜੀਨੀਅਰ ਦੀ ਲਾਈਨ 'ਚ ਪੈਣਾ ਹੁੰਦਾ ਵਾ ਅਤੇ ਇਸ ਚੀਜ਼ ਨੂੰ ਵੇਖਦੇ ਬੱਚੇ ਬਾਹਰ ਤੁਰੇ ਜਾ ਰਹੇ ਜਿਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਪਿਆ ਇਹ ਚੁਣੌਤੀਆਂ ਸਾਡੇ ਸਾਹਮਣੇ ਆਉਣ ਦਈਆਂ ਵਾਂ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਸਾਰੇ ਨੌਜਵਾਨ ਬਾਹਰ ਵੱਲ ਹੀ ਤੁਰੇ ਜਾ ਰਹੇ ਨਾ ਕਿ ਇੱਥੇ ਰਹਿ ਰਹੇ ਆ ਜੇ ਉਹ ਇੱਥੇ ਰਹਿਣਗੇ ਕੋਈ ਆਪਾਂ ਨੂੰ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਫਿਰ ਹੀ ਉਹ ਇੱਥੇ ਰਹਿਣਗੇ ਜੇ ਉਹਨਾਂ ਨੂੰ ਕੋਈ ਇਹ ਚੀਜ਼ ਦਾ ਹੁਨਰ ਹੀ ਨਾ ਹੋਊਗਾ ਜਿਵੇਂ ਹੁਣ ਕੁੜੀਆਂ ਵਾਸਤੇ ਕੋਈ ਪਿੰਡਾਂ ਵਿੱਚ ਸਿਲਾਈ ਸੈਂਟਰ ਖੋਲ੍ਹੇ ਜਾਣ ਜਾਂ ਮੁੰਡਿਆਂ ਵਾਸਤੇ ਕੋਈ ਚੀਜ਼ ਬਣਾਈ ਜਾਵੇ ਜਿਹਨਾਂ ਨਾਲ ਉਹ ਇੱਥੇ ਰਹਿ ਕੇ ਕੰਮ ਕਰ ਸਕਣ ਖੇਤੀਬਾੜੀ ਦੀ ਕੋਈ ਚ ਚੀਜ਼ ਬਣਾਈ ਜਾਵੇ ਜਿਹਨਾਂ ਵਿੱਚ ਉਹਨਾਂ ਨੂੰ ਨਾ ਕੰਮ ਮਿਲ ਸਕੇ ਉਹਨਾਂ ਕੋਲ ਰੁਜ਼ਗਾਰ ਹੋਵੇ ਜੇ ਉਹਨਾਂ ਕੋਲ ਰੁਜ਼ਗਾਰ ਨਹੀਂ ਹੋਏਗਾ ਤਾਂ ਉਹ ਬਾਹਰ ਵੱਲ ਹੀ ਜਾਣਗੇ ਅਤੇ ਸਿੱਖਿਆ ਦੇ ਰੂਪ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਨੂੰ ਤੁਸੀਂ ਵਧੀਆ ਤੋਂ ਵਧੀਆ ਪਿੰਡਾਂ 'ਚ ਚਰਨ ਤਰਨ ਤਾਰਨ ਜ਼ਿਲ੍ਹੇ ਵਿੱਚ ਕੋਲਜ ਵਗੈਰਾ ਬਣਾ ਕੇ ਦਿਉ ਜਿਹਨਾਂ ਨਾਲ ਉਹ ਇੱਥੇ ਰਹਿ ਕੇ ਪੜ੍ਹਾਈ ਕਰ ਸਕਣ ਅਤੇ ਵਧੀਆ ਰੁਜ਼ਗਾਰ ਕਰਨ ਅਤੇ ਵਧੀਆ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣ